ਸਾਡੇ ਪੰਜਾਬ ਦੇ ਵਿੱਚ ਅਤੇ ਸਾਡੇ ਪੰਜਾਬ ਦੇ ਵਿੱਚ ਖੇਤੀ ਨੂੰ ਮੁੱਖ ਰੱਖਿਆ ਜਾਂਦਾ ਹੈ ਬਹੁਤ ਸਾਰੇ ਲੋਕ ਜੋ ਕਿ ਹਜੇ ਵੀ ਬਹੁਤ ਜ਼ਿਆਦਾ ਖੇਤੀਬਾੜੀ ਕਰਦੇ ਹਨ ਜਿਵੇਂ ਕਿ ਸਾਡੇ ਕਿਸਾਨ ਵਾਧੂ ਤਰ੍ਹਾਂ ਨਾਲ ਸਬਜ਼ੀਆਂ ਅਤੇ ਬਹੁਤ ਕੁਛ ਲਗਾਉਂਦੇ ਹਨ ਅਸੀਂ ਜੋ ਕਣਕ ਖਾਂਦੇ ਹਾਂ ਉਹ ਵੀ ਸਾਡੇ ਕਿਸਾਨ ਹੀ ਲਗਾਉਂਦੇ ਹਨ ਇਹਨਾਂ ਨੂੰ ਜਿਵੇਂ ਕਿ ਕਹੀਆਂ ਨਾਲ ਅਤੇ ਮੋਟਰਾਂ ਨਾਲ ਪਾਣੀ ਦੇ ਕੇ ਸਾਡੇ ਖੇਤਾਂ ਦੀ ਸਿੰਚਾਈ ਕੀਤੀ ਜਾਂਦੀ ਹੈ ਬਹੁਤ ਸਾਰੀ ਫਸਲ ਦੇ ਵਿੱਚ ਬਹੁਤ ਸਾਰੀ ਖਾਦ ਵੀ ਮਿਲਾਈ ਜਾਂਦੀ ਹੈ ਤਾਂ ਉਹਦੇ ਨਾਲ ਕੀ ਹੈ ਕਿ ਐਨ ਜਦੋਂ ਫਸਲ ਉਗਾਉਂਦੇ ਹੈ ਤਾਂ ਉਹਦੇ ਵਿੱਚ ਬਹੁਤ ਸਾਰੇ ਕੀਟਨਾਸ਼ਕਾਂ ਦਾ ਵੀ ਪ ਸਾਨੂੰ ਪ੍ਰਯੋਗ ਕਰਨਾ ਪੈਂਦਾ ਹੈ ਜਿਸ ਕਰਕੇ ਕਿ ਸਾਡੀ ਫਸਲ ਜੋ ਹੈ ਉਹ ਖਰਾਬ ਨਾ ਹੋ ਸਕੇ ਤਾਂ ਕਿ ਸਾਡੇ ਕਿਸਾਨ ਬਹੁਤ ਜ਼ਿਆਦਾ ਮਿਹਨਤ ਕਰਕੇ ਹੀ ਫਸਲ ਉਗਾਉਂਦੇ ਹਨ ਅਸੀਂ ਜੋ ਕਣਕ ਦੀ ਰੋਟੀ ਖਾਂਦੇ ਹਾਂ ਤਾਂ ਉਹ ਕਣਕ ਵੀ ਸਾਡੇ ਕਿਸਾਨਾਂ ਦੁਆਰਾ ਹੀ ਲਗਾਈ ਜਾਂਦੀ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖੇਤੀ ਨੂੰ ਮੁੱਖ ਰੱਖਿਆ ਗਿਆ ਹੈ ਲੋਕ ਅੱਜ ਬਹੁਤ ਜ਼ਿਆਦਾ ਜੋ ਕਿ ਘਰ ਹੀ ਸਬਜ਼ੀਆਂ ਫਲ ਫਰੂਟ ਉਗਾਉਂਦੇ ਹਨ ਅਤੇ ਉਹਦੇ ਕਰਕੇ ਕੀ ਹੈ ਬਹੁਤ ਸਾਰੇ ਪੈਸਟੀਸਾਈਡਸ ਤੋਂ ਅਸੀਂ ਬਚ ਰਹੇ ਹਾਂ ਖੇਤੀ ਦੇ ਨਾਲ ਨਾਲ ਸਾਡੀ ਅਸੀਂ ਆਪਦੀ ਜ਼ਮੀਨ ਦੇ ਨਾਲ ਜੁੜੇ ਰਹਿੰਦੇ ਹਾਂ ਸਾਡੀ ਜ਼ਮੀਨ ਜੋ ਕਿ ਬਹੁਤ ਉਪਜਾਊ ਹੈ ਜਿਹਦੇ ਵਿੱਚ ਅਸੀਂ ਬਹੁਤ ਸਾਰਾ ਅਨਾਜ ਉਗਾ ਸਕਦੇ ਹਾਂ ਇਹਦੇ ਨਾਲ ਅਸੀਂ ਬਹੁਤ ਸਾਰਾ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ ਕਿਉਂਕਿ